ਅਸੀਂ ਅਸੀਂ ਦੇਖਦੇ ਹਾਂ ਕਿ ਜਦੋਂ ਕੁਝ ਲਿਖਦੇ ਆਂ ਕੋਈ ਨਾਵਲ ਹੋ ਗਿਆ ਕੋਈ ਮਤਲਬ ਨਾਟਕ ਹੋ ਗਿਆ ਹਨਾ ਕੁਝ ਕੋਈ ਕਵਿਤਾ ਹੋ ਗਈ ਜਿਵੇਂ ਜਿਵੇਂ ਵੀ ਆਪਾਂ ਜਦੋਂ ਅਸੀਂ ਲਿਖਣ ਬੈਠਦੇ ਆਂ ਤਾਂ ਕਈ ਵਾਰੀ ਕੀ ਐ ਬਹੁਤ ਸਾਰੀਆਂ ਵਿਆਕਰਨਿਕ ਜਿਹੜੀਆਂ ਹੈਗੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ ਹਨਾ ਕਈ ਵਾਰੀ ਉਹ ਜਦੋਂ ਕੁਝ ਨਾਵਲ ਵਗੈਰਾ ਲਿਖਦੇ ਹੈਗੇ ਆ ਉਹਦੇ ਵਿੱਚ ਕਈ ਵਾਰੀ ਆਪਾਂ ਨੂੰ ਕਈ ਸਪੈਲਿੰਗ ਨਹੀਂ ਲਿਖਣੇ ਆਉਂਦੇ ਠੀਕ ਐ ਉਹਦੇ ਵਿੱਚ ਕਿ ਆਪਾਂ ਉਹਨੂੰ ਕੀ ਐ ਵਾਰ ਵਾਰ ਸਹੀ ਕਰਦੇ ਆ ਫਿਰ ਹੁਣ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਆਂ ਜੋ ਸਪੈਲਿੰਗ ਹੁੰਦੇ ਆ ਉਹਨਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਕਈ ਵਾਰੀ ਜਦੋਂ ਕਵਿਤਾ ਲਿਖਦੇ ਆ ਹੈਗੇ ਆ ਉਹਦੇ ਵਿੱਚ ਲਹਿ ਨਹੀਂ ਬਣਦੀ ਹੈਗੀ ਤਾਂ ਇਸ ਲਈ ਸਾਨੂੰ ਵਾਰ ਵਾਰ ਕੀ ਐ ਉਹਨੂੰ ਲੈਅ ਦਰ ਬਣਾਨਾ ਪੈਂਦਾ ਹੈਗਾ ਇਸ ਲਈ ਕੀ ਐ ਜੋ ਜੋ ਲਿਖਣ ਦੀ ਕਲਾ ਹੁੰਦੀ ਹੈਗੀ ਠੀਕ ਐ ਉਹਦੇ ਵਿੱਚ ਕੀ ਐ ਵਿਆਕਰਨਿਕ ਇੱਕ ਜਿਹੜੀ ਹੈਗੀ ਐ ਬਣਤਰ ਕੀ ਹੋਣੀ ਜਰੂਰੀ ਹੈਗੀ ਐ ਠੀਕ ਐ ਤੇ ਉਹਨੂੰ ਮਤਲਬ ਕਿਵੇਂ ਲਿਖਿਆ ਗਿਆ ਹੋਇਆ ਲੈਅ ਦਰ ਤਰੀਕੇ ਨਾਲ ਲਿਖਿਆ ਗਿਆ ਹੋਇਆ ਤੇ ਤੇ ਜਿਵੇਂ ਉਹਦੇ ਜਿਹੜੇ ਉਹਦੇ ਸਪੈਲਿੰਗ ਹੈਗੇ ਅੱਖਰਾਂ ਦੇ ਬਨਾਵਟ ਹੈਗੀ ਆ ਠੀਕ ਐ ਉਹਨੂੰ ਵਿਆਕਰਨ ਜਿਹੜੀ ਹੈਗੀ ਉਹਦੀ ਸਹੀ ਹੈਗੀ ਐ ਠੀਕ ਐ ਸਭ ਮਤਲਬ ਮਾਤਰਾ ਵਗੈਰਾ ਦਾ ਧਿਆਨ ਰੱਖਣਾ ਪੈਂਦਾ ਹੈਗਾ ਕਿ ਜੋ ਲਿਖਿਆ ਉਹ ਸਹੀ ਲਿਖਿਆ ਹੋਇਆ ਠੀਕ ਐ ਜੋ ਬਣ ਰਹੀ ਐ ਲੈਅ ਬਣ ਰਹੀ ਉਹ ਸਹੀ ਬਣ ਰਹੀ ਹੈਗੀ ਆ ਤਾਂ ਉਹਦੇ ਵਿੱਚ ਕੀ ਇਹ ਜਿਹੜੀਆਂ ਹੈਗੀਆਂ ਕਿ ਸਾਡੀ ਜਿਹੜੀ ਆ ਲਿਖਣ ਕਲਾ ਨੂੰ ਕੀ ਐ ਬਹੁਤ ਜਿਆਦਾ ਪ੍ਰਭਾਵਿਤ ਕਰਦੀਆਂ ਹੈਗੀਆਂ ਠੀਕ ਐ ਜਿਵੇਂ ਕਿ ਮੈਂ ਬੁੱਕਸ ਵਗੈਰਾ ਪੜਦੀ ਰਹਿੰਦੀ ਹੈਗੀ ਆ ਠੀਕ ਐ ਮੈਨੂੰ ਲਿਖਣ ਦਾ ਸ਼ੌਂਕ ਮੇਰੇ ਜਿਹੜੇ ਮੇਰੇ ਟੀਚਰ ਹੈਗੇ ਆ ਪ੍ਰੋਫੈਸਰ ਬਲਜਿੰਦਰ ਸਿੰਘ ਠੀਕ ਐ ਉਹਨਾਂ ਤੋਂ ਮਤਲਬ ਮਿਲਿਆ ਸੀਗਾ ਮਤਲਬ ਮੈਂ ਉਹਨਾਂ ਤੋਂ ਪ੍ਰੇਰਿਤ ਹੋਈ ਸੀ ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਥੋੜਾ ਥੋੜਾ ਪਹਿਲਾਂ ਮਤਲਬ ਲਿਖਣਾ ਸ਼ੁਰੂ ਕੀਤਾ ਠੀਕ ਐ ਹੁਣ ਮੇਰੀ ਮਤਲਬ ਜਿਹੜੀ ਹੈਗੀ ਆ ਉਹ ਫਿਰ ਉਸ ਤੋਂ ਬਾਅਦ ਬੁੱਕਸ ਪੜਨੀਆਂ ਸ਼ੁਰੂ ਕੀਤੀਆਂ ਉਹਨਾਂ ਤੋਂ ਮੈਂ ਹੋਰ ਜਿਆਦਾ ਪ੍ਰੇਰਿਤ ਹੋਈ ਠੀਕ ਐ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਸ਼ਨ ਦਿੱਤਾ ਹੈਗਾ ਵੀ ਕਿਵੇਂ ਆਪਾਂ ਲਿਖ ਸਕਦੇ ਆ ਆਪਦੀ ਲਾਈਫ ਨੂੰ ਵੀ ਕਿਵੇਂ ਆਪਾਂ ਇਕ ਵਰਡਸ ਦੇ ਵਿੱਚ ਕਿਵੇਂ ਆਪਾਂ ਉਸਾਰ ਸਕਦੇ ਹੈਗੇ ਆ ਵਰਡ ਦੇ ਵਿੱਚ ਕਿਵੇਂ ਆਪਾਂ ਉਹਨੂੰ ਉਤਾਰ ਸਕਦੇ ਆ ਦੀ ਲਾਈਫ ਦੇ ਵਿੱਚ ਜੋ ਹੋ ਰਿਹਾ ਹੈਗਾ ਉਹਨੂੰ ਸ਼ਬਦਾਂ ਦੇ ਵਿੱਚ ਕਿਵੇਂ ਆਪਾਂ ਬਿਆਨ ਕਰ ਸਕਦੇ ਹੈਗੇ ਆ ਤਾਂ ਉਹਦੇ ਨਾਲ ਕੀ ਐ ਕਿ ਸਾਡੀ ਜਿਹੜੀ ਹੈਗੀ ਆ ਉਹ ਦਿਮਾਗੀ ਵਿਕਾਸ ਹੁੰਦਾ ਹੈਗਾ ਠੀਕ ਐ ਪਰ ਇੱਤੇ ਮੈਂ ਜੋ ਵੀ ਜਿੰਨਾ ਵੀ ਹੁਣ ਤੱਕ ਮੈਂ ਸਿੱਖਿਆ ਹੈਗਾ ਕੁਝ ਮਤਲਬ ਜਿਵੇਂ ਰਿਸਰਚ ਕਰਕੇ ਗੂਗਲ ਵਗੈਰਾ ਤੋਂ ਸਰਚ ਕਰਕੇ ਯਾ ਫਿਰ ਜਿਹੜੀਆਂ ਵੀ ਮੈਂ ਬੁੱਕਸ ਪੜੀਆਂ ਉਹਨਾਂ ਤੋਂ ਸਿੱਖਿਆ ਹੈਗਾ ਮੈਂ ਕੋਈ ਮਤਲਬ ਕਿਸੇ ਤਰੀਕੇ ਦਾ ਕੋਈ ਕੋਰਸ ਨਹੀਂ ਲਿਆ ਗਾ ਜੋ ਵੀ ਮੈਂ ਹੁਣ ਤੱਕ ਜਿਹਨੀਆਂ ਵੀ ਕਿਤਾਬਾਂ ਪੜ੍ਹੀਆਂ ਹੈਗੀਆਂ ਮੈਂ ਉਹਨਾਂ ਤੋਂ ਵੀ ਸਿੱਖ ਸਿੱਖ ਕੇ ਲਿਖਿਆ ਹੈਗਾ ਜਿੰਨਾ ਵੀ ਲਿਖਿਆ ਹੈਗਾ ਪਰ ਮੈਨੂੰ ਮਤਲਬ ਮੈਂ ਆਪਦੇ ਆਪ ਨੂੰ ਹੋਰ ਜਿਆਦਾ ਮਤਲਬ ਸੁਧਾਰ ਰਹੀ ਹੈਗੀ ਆਂ ਲਿਖਣ ਕਲਾ ਦੇ ਵਿੱਚ ਠੀਕ ਐ ਆਪਦੇ ਆਪ ਨੂੰ ਮਤਲਬ ਸਹੀ ਬਣਾਉਣ ਦੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਕਿ ਮਤਲਬ ਜੋ ਮੇਰੀ ਲਿਖਣ ਕਲਾ ਹੈਗੀ ਆ ਮੈਨੂੰ ਆਪਦੀਆਂ ਸ਼ਿਖਰਾਂ ਤੱਕ ਲੈ ਕੇ ਜਾਵੇ ਮੇਰੇ ਜੋ ਸੁਪਨਾ ਹੈਗਾ ਬੁੱਕ ਪਬਲਿਸ਼ ਕਰਨ ਦਾ ਉਹਨੂੰ ਪੂਰਾ ਕਰੇ ਇਸ ਲਈ ਮੈਂ ਆਪਦੇ ਇਸ ਸੁਪਨੇ ਤੇ ਧਿਆਨ ਦਿੰਦੀ ਹੈਗੀਆ ਜਦੋਂ ਵੀ ਮੈਨੂੰ ਟਾਈਮ ਮਿਲਦਾ ਹੈਗਾ ਮੈਂ ਲਿਖਦੀ ਆਂ ਫਰੀ ਟਾਈਮ ਦੇ ਵਿੱਚ ਬੈਠ ਕੇ ਲਿਖਦੀ ਆ ਚਾਹੇ ਮੈਂ ਦੋ ਲਾਈਨਸ ਲਿਖਾਂ ਪਰ ਮੈਂ ਲਿਖਦੀ ਆਂ ਇਸ ਲਈ ਜਦੋਂ ਵੀ ਮੈਨੂੰ ਟਾਈਮ ਮਿਲਦਾ ਮੈਂ ਉਦੋਂ ਲਿਖਦੀ ਆਂ ਟਾਈਮ ਕੱਢ ਕੇ ਵੀ ਲਿਖਦੀ ਹੈਗੀ ਆ ਤੇ ਆਪਦੀ ਇਸ ਕਲਾ ਤੇ ਬਹੁਤ ਜਿਆਦਾ ਧਿਆਨ ਦਿੰਦੀ ਹੈਗੀ ਆ ਉਹ ਤੇ ਆਪਦੇ ਆਪ ਨੂੰ ਮਤਲਬ ਕੀ ਐ ਆਪਦੇ ਆਪ ਨੂੰ ਸੁਧਾਰ ਰਹੀ ਹੈਗੀ ਆ ਇਸ ਕਲਾ ਦੇ ਪ੍ਰਤੀ ਤੇ ਇਸ ਲਈ ਤਾਂ ਕਿ ਮੈਂ ਆਪਦਾ ਜਿਹੜਾ ਜਿਹੜਾ ਮੇਰਾ ਸੁਪਨਾ ਹੈਗਾ ਬੁੱਕ ਬੁੱਕ ਪਬਲਿਸ਼ ਕਰਨ ਦਾ ਕੀ ਮੈਂ ਉਹਨੂੰ ਮਤਲਬ ਜਲਦੀ ਤੋਂ ਜਲਦੀ ਪੂਰਾ ਕਰ ਸਕਾਂ ਤੇ ਆਪਦਾ ਨਾਮ ਕੀ ਐ ਚਮਕਾ ਸਕਾਂ ਤੇ ਮੇਰੇ ਮੰਮੀ ਡੈਡੀ ਦਾ ਨਾਮ ਵੀ ਕੀ ਐ ਚਮਕਾ ਸਕਾਂ ਜੀ ਹਾਂਜੀ ਧੰਨਵਾਦ